ਹੈਲੋ ਹਾਂ ਜੀ ਠੀਕ ਮੋਹਾਲੀ ਤੋਂ ਮੋਹਾਲੀ ਤੋਂ ਚੰਡੀਗੜ੍ਹ ਵੀ ਜਾਂਦੀ ਹੈ ਰੋਪੜ ਵੀ ਜਾਂਦੀ ਹੈ ਔਰ ਲੁਧਿਆਣੇ ਵੀ ਜਾਂਦੀ ਹੈ ਖਰੜ ਅੰਬਰਸਰ ਤੁਸੀਂ ਦੱਸੋ ਕਿਹੜੀ ਜਗ੍ਹਾ 'ਤੇ ਜਾਣਾ ਜੇ ਤੁਸੀਂ ਲੋਕਲ 'ਤੇ ਜਾਵੋਂਗੇ ਲੋਕਲ ਦਾ ਜਦ ਕਿਰਾਇਆ ਹੈਗਾ ਨੱਬੇ ਰੁਪਏ ਇੱਕ ਬੰਦੇ ਦਾ ਜੇ ਦੂਜੀ 'ਚ ਜਾਵੋਂਗੇ ਐਕਸਪ੍ਰੇਸ ਏ ਸੀ ਵਾਲੀ 'ਚ ਉਹਦਾ ਹੈਗਾ ਡੇਢ ਸੌ ਚਾਰਜ ਇੱਕ ਬੰਦੇ ਦਾ ਉਹਦੇ ਵਿੱਚ ਸਾਫ ਸਫਾਈ ਵੀ ਐਨ ਹੋਵੇਗਾ ਅਤੇ ਲੋਕਲ ਦਾ ਤਾਂ ਜੋ ਵੀ ਹੈ ਐਂਕਣੀ ਹੈ ਹਾਂ ਨਹੀਂ ਉਹ ਤੁਹਾਨੂੰ ਆਪ ਮੁੱਲ ਲੈਣੇ ਪੈਣੇ ਹੈ ਸਵੇਰੇ ਨੌ ਵਜੇ ਤੋਂ ਸ਼ੁਰੂ ਹੈ ਨੌ ਇੱਕ ਬਾਰਾਂ ਵਜੇ ਹੈ ਦੁਪਹਿਰ ਦੇ ਇੱਕ ਸ਼ਾਮ ਨੂੰ ਚਾਰ ਵਜੇ ਹੈ ਇੱਕ ਰਾਤ ਦੇ ਅੱਠ ਵਜੇ ਹੈ ਇੱਕ ਰਾਤ ਦੇ ਗਿਆਰਾਂ ਵਜੇ ਚੱਲੋਂ ਠੀਕ ਹੈ ਜੀ